ਹਾਂਜੀ ਪਿਛਲੇ ਕੁਝ ਸਮੇਂ ਦੌਰਾਨ ਨੌਕਰੀ ਦੇ ਵਿੱਚ ਯੂਟਿਊਬਰ ਦਾ ਜਿਹੜਾ ਉਨ੍ਹਾਂ ਦਾ ਕੰਮ ਤਾਂ ਕੁਛ ਚੱਲਿਆ ਉਨ੍ਹਾਂ ਤੋਂ ਕੁਛ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਾਪਤ ਹੋਇਆ ਹੈ ਅਤੇ ਕਮੇਡੀਅਨ ਦੇ ਵਿੱਚ ਵੀ ਕੁਝ ਕਮੇਡੀਅਨ ਜਿਹੜੇ ਹੈਗੇ ਆ ਫ਼ਿਲਮਾਂ ਦੇ ਵਿੱਚ ਆ ਰਹੇ ਨੇ ਪਰ ਇੱਕ ਗੱਲ ਇਹ ਹੈ ਵੀ ਜਿਹੜੇ ਵੀ ਇੱਥੇ ਬਹੁਤ ਜ਼ਿਆਦਾ ਜਿਹੜੀ ਭਾਰਤ ਦੇ ਵਿੱਚ ਉਹ ਬੱਚੇ ਜਾਂ ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਤਾਂ ਕਰ ਗਏ ਨੇ ਪਰ ਉਨ੍ਹਾਂ ਨੂੰ ਉਨ੍ਹਾਂ ਦੀ ਸਿੱਖਿਆ ਦੇ ਮੁਤਾਬਕ ਸਕਿੱਲ ਦੇ ਮੁਤਾਬਕ ਐਜੂਕੇਸ਼ਨ ਦੇ ਮੁਤਾਬਕ ਜਿਹੜਾ ਰੁਜ਼ਗਾਰ ਹੈ ਉਹ ਪ੍ਰਾਪਤ ਨਹੀਂਂ ਹੋਇਆ ਇਸ ਲਈ ਕੁਛ ਨਿਰਾਸ਼ ਹੋ ਕੇ ਨਸ਼ਿਆਂ ਵੱਲ ਧੱਕੇ ਗਏ ਨੇ ਅਤੇ ਕੁਛ ਆ ਜਿਹੜੇ ਉਹ ਖੁਦਕੁਸ਼ੀਆਂ ਵੀ ਕਰਦੇ ਨੇ ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤੀਆਂ ਨੇ ਇੱਥੋਂ ਜਿਹੜੀ ਨੌਜਵਾਨ ਪੀੜ੍ਹੀ ਹੈ ਇੱਥੋਂ ਪਲਾਇਨ ਕਰਕੇ ਉਨ੍ਹਾਂ ਨੇ ਵਿਦੇਸ਼ਾਂ ਵੱਲ ਜਿਹੜਾ ਪ੍ਰਵਾਸ ਲਈ ਰੁੱਖ ਹੈ ਜਿਹੜਾ ਉਹ ਕਰ ਲਿਆ ਹੈ ਕਿਉਂਕਿ ਇੱਥੇ ਉਨ੍ਹਾਂ ਨੂੰ ਆਪਣੀ ਐਜੂਕੇਸ਼ਨ ਦੇ ਮੁਤਾਬਕ ਰੁਜ਼ਗਾਰ ਜਿਹੜਾ ਨਹੀਂ ਮਿਲ ਰਿਹਾ ਹੈਗਾ ਇਸ ਲਈ ਉਹ ਆਪਣੀ ਜ਼ਿੰਦਗੀ ਬਸਰ ਕਰਨ ਦੇ ਲਈ ਉਨ੍ਹਾਂ ਦੀ ਇੱਕ ਮਜਬੂਰੀ ਬਣ ਗਈ ਹੈ ਵਿਦੇਸ਼ਾਂ ਦੇ ਵਿੱਚ ਜਾਣਾ ਅਤੇ ਉੱਥੇ ਰੁਜ਼ਗਾਰ ਨੂੰ ਤਲਾਸ਼ਣਾ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਏ ਆ ਕਿ ਜਿਹੜੀ ਇੱਥੇ ਐਜੂਕੇਸ਼ਨ ਦੀ ਜਿਹੜੀ ਹਾਲਤ ਆ ਉਹਦੇ ਵਿੱਚ ਬੱਚਿਆਂ ਨੇ ਕਾਫ਼ੀ ਜ਼ਿਆਦੇ ਜਿਹੜੇ ਸਕਿੱਲਡ ਹੈਗੇ ਨੇ ਅਤੇ ਨਾਲ ਹੀ ਬਹੁਤ ਉਚੇਰੀ ਸਿੱਖਿਆ ਪ੍ਰਾਪਤ ਕਰ ਗਏ ਨੇ ਉਹ ਯੋਗ ਵੀ ਹੈਗੇ ਨੇ ਅਤੇ ਉਨ੍ਹਾਂ ਨੂੰ ਇੱਥੇ ਹੀ ਭਾਰਤ ਦੇ ਵਿੱਚ ਰੁਜ਼ਗਾਰ ਮੁਹੱਈਆ ਕਰੇ ਤਾਂ ਕਿ ਉਹ ਆਪਣੇ ਦੇਸ਼ ਦੇ ਵਿਕਾਸ ਦੇ ਵਿੱਚ ਹਿੱਸਾ ਪਾ ਸਕਣ